ਹਾਂਜੀ ਪੰਜਾਬੀ ਭੋਜਨ ਵਿਅੰਜਨ ਚੈਨਲ ਜਿਹੜੇ ਇਹ ਯੂਟੀਊਬ 'ਤੇ ਹੈਗੇ ਆ ਕਰੇਜੀ ਫੂਡ ਬਣਾਓ ਖਾਓ ਬਰਾਉਨਸ ਕਿਚਨ ਪੰਜਾਬੀ ਤੜਕਾ ਮਾਂ ਮੈਂ ਕੈਸੇ ਕਰੂ ਹੈਗੇ ਗੇ ਨਾ ਇਹਨਾਂ ਇਹ ਜਿਹੜੇ ਆ ਸਾਰੇ ਹੀ ਐਨਾ ਇਹਨਾਂ ਵਿੱਚ ਵਧੀਆ ਭੋਜਨ ਪਕਵਾਨ ਤਿਆਰ ਕਰਨਾ ਦੱਸਦੇ ਆ ਪਰ ਇਹਨਾਂ ਚੋਂ ਜਿਹੜਾ ਹੈਗਾ ਵਾ ਉਹ ਫੇਵਰਟ ਹੈਗਾ ਵਾ ਸਾਡਾ ਪਸੰਦੀਦਾ ਉਹ ਪੰਜਾਬੀ ਤੜਕਾ ਕਿਉਂਕਿ ਉਸਦੇ ਵਿੱਚ ਜੋ ਪੰਜਾਬ 'ਚ ਭੋਜਨ ਬਣਾਏ ਜਾਂਦੇ ਆ ਉਹ ਸਾਰੇ ਹੀ ਬੜੇ ਵਧੀਆ ਤਰੀਕੇ ਨਾਲ ਦੱਸੇ ਹੁੰਦੇ ਆ ਜਿਹੜੇ ਕਿ ਆਸਾਨੀ ਨਾਲ ਅਸੀਂ ਵੀ ਭੋਜਨ ਘਰ 'ਚ ਹੀ ਤਿਆਰ ਕਰ ਸਕਦੇ ਜਿਵੇਂ ਰੈਸਟੋਰੈਂਟਾਂ ਵਰਗਾ ਹੈ ਅਤੇ ਇਸ ਤੋਂ ਇਲਾਵਾ ਟੀ ਵੀ 'ਤੇ ਜਿਹੜੇ ਹੋਮ ਮਾਸਟਰ ਸ਼ੈਫ ਇੰਡੀਆ ਮੰਮੀ ਕਾ ਮੈਜਿਕ ਇੰਡੀਆ ਵਿਲਜ਼ ਕੁਕਿੰਗ ਟਰਬਨ ਤੜਕਾ ਇਹ ਪੰਜਾਬੀ ਜਿਹੜੇ ਇਹ ਟੀ ਵੀ 'ਤੇ ਪ੍ਰੋਗਰਾਮ ਦਿਖਾਏ ਜਾਂਦੇ ਆ ਇਹਨਾਂ ਚੋਂ ਵੀ ਪੰਜਾਬੀ ਜਿਹੜਾ ਟਰਬਨ ਤੜਕਾ ਨਾ ਉਹਦੇ ਵਿੱਚ ਪੰਜਾਬੀ ਡਿਸ਼ਾਂ ਹੋਰ ਵੀ ਬੜਾ ਕੁਛ ਐਨਾ ਵਧੀਆ ਵਧੀਆ ਡਿਸ਼ਾਂ ਤਿਆਰ ਕਰ ਕੀਤੀਆਂ ਜਾਂਦੀਆਂ ਜਿਹੜੀਆਂ ਕਿ ਆਸਾਨੀ ਨਾਲ ਹੀ ਅਸੀਂ ਬਣਾ ਸਕਦੇ ਆ ਅਤੇ ਆਪਣੇ ਪਰਿਵਾਰ ਦੇ ਲਈ ਉਹਨਾਂ ਨੂੰ ਅਸੀਂ ਉਹਨਾਂ ਸਾਹਮਣੇ ਪੇਸ਼ ਕਰ ਸਕਦੇ ਹਾਂ ਜਿਵੇਂ ਕਿ ਬੱਚੇ ਅੱਜ ਕੱਲ੍ਹ ਪਸੰਦ ਕਰਦੇ ਹੈਗੇ ਐਨਾ ਹੋਰ ਵੀ ਜਿਹੜੇ ਸਾਰੇ ਚੈਨਲ ਇਹਨਾਂ ਵਾ ਵੀ ਬੜੇ ਵਧੀਆ ਇਹਨਾਂ ਚੈਨਲ ਆ ਜਿੰਨ੍ਹਾਂ ਨੂੰ ਅਸੀਂ ਸਿੱਖਦੇ ਹਾਂ ਅਤੇ ਆਪਣੇ ਘਰ 'ਚ ਹੀ ਡਿਸ਼ ਤਿਆਰ ਕਰਦੇ ਸਾਨੂੰ ਬਾਹਰੋਂ ਮੰਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹਾਂਜੀ ਪੰਜਾਬੀ ਤੜਕਾ ਜਿਹੜਾ ਉਹ ਮਨਪਸੰਦ ਐਨਾ ਉਹਦੇ ਵਿੱਚ ਜਿਹੜਾ ਕਿ ਪੰਜਾਬ ਤੋਂ ਹੀ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਮੇਨ ਡਿਸ਼ਾਂ ਹੁੰਦੀਆਂ ਨਾ ਤਿਆਰ ਕੀਤੀਆਂ ਜਾਂਦੀਆਂ ਉਹਨਾਂ ਨੂੰ ਵਧੀਆ ਹੋਰ ਵੀ ਸਵਾਦਿਸ਼ਟ ਬਣਾਉਣ ਲਈ ਉਹਨਾਂ ਵਿੱਚ ਕਿਹੜੇ ਮਸਾਲੇ ਪਾਏ ਜਾਂਦੇ ਹੈ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਉਹ ਦੱਸਿਆ ਜਾਂਦਾ ਨਾ ਅਤੇ ਹਾਂਜੀ